ਆਮ ਤੌਰ 'ਤੇ ਖਾਣਾ ਪਕਾਉਂਦੇ ਸਮੇਂ ਜਾਂ ਖਾਣਾ ਬਣਾਉਂਦੇ ਸਮੇਂ ਅਤੇ ਖਾਂਦੇ ਸਮੇਂ ਕਈ ਤਰ੍ਹਾਂ ਦੇ ਵਹਿਮ ਭਰਮ ਅਪਣਾਏ ਜਾਂਦੇ ਹਨ ਜਿਵੇਂ ਕਿ ਖਾਣਾ ਖਾਂਦੇ ਸਮੇਂ ਬੋਲਣਾ ਔਰ ਲੱਤਾਂ ਹਿਲਾਉਣਾ ਬਹੁਤ ਅਸ਼ੁੱਭ ਮੰਨਿਆ ਜਾਂਦਾ ਹੈ ਖਾਣਾ ਪਕਾਉਣ ਤੋਂ ਬਾਅਦ ਚਕਲਾ ਵੇਲਣਾ ਸਾਫ ਸੁਥਰਾ ਰੱਖ ਕਰਕੇ ਰੱਖਣਾ ਚਾਹੀਦਾ ਹੈ ਚਕਲੇ ਨੂੰ ਆਮ ਤੌਰ 'ਤੇ ਸਿੱਧਾ ਖੜ੍ਹਾ ਕਰਕੇ ਰੱਖਣਾ ਚਾਹੀਦਾ ਹੈ ਤਵੇ ਨੂੰ ਹਮੇਸ਼ਾ ਲੁਕਾ ਕੇ ਰੱਖਣਾ ਚਾਹੀਦਾ ਹੈ ਹੋਰ ਵੀ ਇਸ ਤਰ੍ਹਾਂ ਦੇ ਨਿੱਕੇ ਨਿੱਕੇ ਕਿੰਨੇ ਸਾਰੇ ਵਹਿਮ ਭਰਮ ਹਨ ਜੋ ਆਮ ਤੌਰ 'ਤੇ ਸਮਾਜ ਵਿੱਚ ਪ੍ਰਚਲਿਤ ਹਨ